ਮੇਰੇ ਸਮਝ ਮੁਤਾਬਕ ਕਿਸੇ ਹੋਰ ਬ੍ਰਹਿਮੰਡ ਦੇ ਉੱਤੇ ਜੀਵਨ ਦਾ ਹੋਰ ਹੋਣਾ ਮੁਸ਼ਕਲ ਹੈ ਕਿਉਂਕਿ ਜਿਸ ਤਰ੍ਹਾਂ ਸੂਰ ਚੰਦਰਮਾ ਦੇ ਉੱਤੇ ਜਾਂ ਮੰਗਲ ਗ੍ਰਹਿ ਦੇ ਉੱਤੇ ਪਾਣੀ ਆਕਸੀਜਨ ਵਗੈਰਾ ਨਹੀਂ ਹੈਗੀ ਵੈਸੇ ਇੰਡੀਆ ਨੇ ਜਿਹੜਾ ਚੰਦਰਯਾਨ ਥਰੀ ਭੇਜਿਆ ਉਹਦੇ ਨਾਲ ਹੋ ਸਕਦਾ ਕੋਈ ਨਵੀਆਂ ਨਵੀਆਂ ਜਿਹੜੀਆਂ ਉਸ ਖੋਜਾਂ ਸਾਹਮਣੇ ਆਉਣ ਜਿਹਦੇ ਨਾਲ ਪਾਣੀ ਦੀ ਖੋਜ ਹੋ ਸਕੇ ਜੇਕਰ ਪਾਣੀ ਔਰ ਆਕਸੀਜਨ ਨਹੀਂ ਹੈਗੀ ਤਾਂ ਉਹਦੇ ਨਾਲ ਉਹ ਤੋਂ ਬਿਨਾਂ ਜੀਵਨ ਦਾ ਰਹਿਣਾ ਬੜਾ ਮੁਸ਼ਕਲ ਹੈ ਉਸੇ ਤਰ੍ਹਾਂ ਉੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਖ ਫਸਲ ਕੋਈ ਖਾਣ ਦਾ ਪ੍ਰਬੰਧ ਕੋਈ ਬੂਟੇ ਦਾ ਨਹੀਂ ਹੋ ਸਕਦਾ ਇਸ ਕਰਕੇ ਇਨਸਾਨ ਉੱਥੇ ਹੀ ਰਹਿ ਸਕਦਾ ਜਿੱਥੇ ਆਕਸੀਜਨ ਹੋਵੇ ਉੱਥੇ ਆਕਸੀਜਨ ਦੀ ਅਜੇ ਤੱਕ ਲੱਗਦਾ ਜੋ ਬੜੀ ਘਾਟ ਹੈ ਪਰ ਹੁਣ ਜੋ ਦੇਖੋ ਕ ਤਿੰਨ ਚੰਦਰਯਾਨ ਗਿਆ ਥਰੀ ਇਹਦੇ ਨਾਲ ਹੋ ਸਕਦਾ ਕੋਈ ਨਵਾਂ ਕੋਈ ਐਂ ਉਹ ਨਵਾਂ ਕੋਈ ਉਹ ਨਵੀਂ ਕੋਈ ਕਾਢ ਨਿਕਲੇ ਜਿਹਦੇ ਨਾਲ ਸੰਭਵ ਹੋ ਸਕੇ ਪਰ ਮੈਨੂੰ ਲੱਗਦਾ ਕਿਤੇ ਹੋਰ ਬ੍ਰਹਿਮੰਡ 'ਤੇ ਜੀਵਨ ਬੜਾ ਮੁਸ਼ਕਲ ਹੈ